ਹਾਂਜੀ ਸਤਿ ਸ਼੍ਰੀ ਅਕਾਲ ਕਿਉਂ ਮੈਂ ਤੁਹਾਨੂੰ ਆਪਣੇ ਜਿਹੜੇ ਤੁਸੀਂ ਮੈਨੂੰ ਅੱਜ ਵਿਸ਼ਾ ਦਿੱਤਾ ਕਿ ਤੁਸੀਂ ਆਪਣੇ ਕੱਪੜੇ ਘਰ ਸਵਾਉਂਦੇ ਹੋ ਜਾਂ ਬਾਹਰ ਸਵਾਉਂਦੇ ਹੋ ਅਤੇ ਉਹਦੇ ਉੱਤੇ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਿਹੜਾ ਯਾਨੀ ਕਿ ਜਿਹੜੇ ਇਹ ਕੰਮ ਕੱਪੜੇ ਆ ਇਹ ਮੈਂ ਆਪ ਖੁਦ ਆਪਣੇ ਘਰ ਹੀ ਸੀਨੀ ਹਾਂ ਮੈਂ ਮੈਨੂੰ ਬਹੁਤੀ ਟਾਈਮ ਹੋ ਗਿਆ ਕੋਈ ਘੱਟੋ ਘੱਟ ਮੈਨੂੰ ਪੱਚੀ ਸਾਲ ਹੋ ਗਏ ਮੈਂ ਆਪਣੇ ਕੰਮ ਖੁਦ ਕਰਦੀ ਹਾਂ ਮੈਂ ਆਪਣੀ ਬੇਟੀਆਂ ਦੇ ਵੀ ਆਪਣੀ ਸਾਸੂ ਮਾਂ ਦੇ ਵੀ ਯਾਨੀ ਕਿ ਮੈਂ ਘਰ ਸਿਉਂਦੀ ਹਾਂ ਅਤੇ ਮੈਂ ਕਸਟਮਰ ਵੀ ਮੇਰੇ ਵਨ ਮਤਲਬ ਸ਼ਹਿਰ ਦੇ ਵਿੱਚ ਬਣੀ ਹੋਈ ਆ ਵਧੀਆ ਕੰਮ ਮੇਰਾ ਚੱਲ ਰਿਹਾ ਅਤੇ ਮੈਂ ਬਾਹਰੋਂ ਨਹੀਂ ਕਦੇ ਸਵਾਇਆ ਜੇ ਮੈਨੂੰ ਸਵਾਉਣਾ ਵੀ ਪਵੇ ਤਾਂ ਮੈਨੂੰ ਸਵਾਈ ਦੇਣੀ ਵੀ ਔਖੀ ਲੱਗਦੀ ਆ ਅਤੇ ਜਦੋਂ ਯਾਨੀ ਕਿ ਮੈਂ ਆਪਣੇ ਘਰ ਮੇਰੇ ਫੰਕਸ਼ਨ ਸੀ ਮੈਂ ਤਿੰਨ ਪਲਾਜੋ ਸਵਾਏ ਸੀਗੇ ਮਤਲਬ ਉਹ ਮੈਨੂੰ ਦੇਣੇ ਬੜੇ ਔਖੇ ਲੱਗੇ ਸਵਾਈ ਬਾਜ਼ਾਰ ਦੀ ਬਹੁਤ ਮਹਿੰਗੀ ਆ ਇਹ ਯਾਨੀ ਕਿ ਜਿਹੜੀ ਮੈਨੂੰ ਮੇਰੀ ਆਪਣੀ ਸਵਾਈ ਆ ਅਤੇ ਬਾਜ਼ਾਰ ਨਾਲੋਂ ਬਹੁਤ ਘੱਟ ਰੇਟ 'ਤੇ ਆ ਘੱਟ ਰੇਟ 'ਤੇ ਆ ਜਿਸ ਕਰਕੇ ਮੇਰੀ ਆਪਾਂ ਮੇਰਾ ਕੰਮ ਵੀ ਵੈਸੇ ਬਹੁਤ ਜ਼ਿਆਦਾ ਸਫਾਈ ਵਾਲਾ ਮੇਰੇ ਕਸਟਮਰ ਬਹੁਤ ਮੇਰੇ 'ਤੇ ਸਹੀ ਖੁਸ਼ ਹੁੰਦੇ ਨੇ ਅਤੇ ਜਿਹੜੀ ਇਹ ਜਿਹੜੀ ਬਾਹਰਲੀ ਸਵਾਈ ਆ ਬਾਹਰ ਸ ਹੈਗੀ ਆ ਸਵਾਈ ਬਹੁਤ ਜ਼ਿਆਦਾ ਲਾਈਨਿੰਗ ਵਾਲੇ ਸੂਟ ਦੀ ਮਤਲਬ ਜਿਹੜੀ ਆ ਕਿ ਜਿਹੜੀ ਮੈਂ ਲੈ ਰਹੀ ਹਾਂ ਅੱਜ ਦੇ ਟਾਈਮ 'ਚ ਸਾਢੇ ਛੇ ਸੌ ਲੈ ਰਹੀ ਹਾਂ ਅਤੇ ਜਿਹੜਾ ਮਾਰਕੀਟ ਰੇਟ ਹੈ ਉੱਥੇ ਬਾਰ੍ਹਾਂ ਸੌ ਵੀ ਚੱਲ ਰਿਹਾ ਫੁੱਲ ਲਾਈਨਿੰਗ ਵਾਲਾ ਜਿਹੜਾ ਹਾਫ ਲਾਈਨਿੰਗ ਵਾਲਾ ਮੇਰਾ ਰੇਟ ਜਿਹੜਾ ਚੱਲ ਰਿਹਾ ਉਹ ਹੈਗਾ ਸਾਢੇ ਪੰਜ ਸੌ ਅਤੇ ਮਾਰਕੀਟ ਰੇਟ ਚੱਲ ਰਿਹਾ ਅੱਠ ਸੌ ਰੁਪਈਆ ਅਤੇ ਜਿਹੜਾ ਜਿਹੜਾ ਜਮਾਂ ਹੀ ਆਪਾਂ ਸਿੰਪਲ ਕਹਿ ਦਿੰਦੇ ਜਿਹਦੇ 'ਤੇ ਕੋਈ ਵੀ ਲੈਸਸ ਵਗੈਰਾ ਨਹੀਂ ਲੱਗਦੀ ਉਹ ਵੀ ਯਾਨੀ ਕਿ ਆਪਣਾ ਮੇਰਾ ਤਿੰਨ ਸੌ ਚੱਲ ਰਿਹਾ ਮਾਰਕੀਟ ਰੇਟ ਪੰਜ ਸੌ ਚੱਲ ਰਿਹਾ ਇਸ ਕਰਕੇ ਨਾ ਯਾਨੀ ਕਿ ਮੈਨੂੰ ਸਵਾਈ ਦੇਣੀ ਔਖੀ ਲੱਗਦੀ ਹੈ ਮੈਂ ਆਪਣੀਆਂ ਯਾਨੀ ਕਿ ਇਹਦੇ ਵਿੱਚ ਮੈਂ ਬਾਹਰੋਂ ਸਵਾਉਣਾ ਪਸੰਦ ਹੀ ਨਹੀਂ ਕਰਦੀ ਅਤੇ ਚਲੋ ਠੀਕ ਆ ਆਪਣਾ ਆਪਣਾ ਹਿਸਾਬ ਹੁੰਦਾ ਇਹ ਜਿਹੜਾ ਯਾਨੀ ਕਿ ਜਿਹੜੇ ਤੁਸੀਂ ਮੈਨੂੰ ਹੁਣ ਇਹ ਗੱਲ ਵੀ ਪੁੱਛੀ ਆ ਕਿ ਕਿਹੜੀਆਂ ਗੱਲਾਂ ਹਨ ਜਿਹੜੀਆਂ ਕਿ ਜਿਹੜੀਆਂ ਮੈਨੂੰ ਜੇ ਮੈਂ ਉਹਦੇ ਵਿੱਚ ਕੱਚੀ ਹਾਂ ਵੈਸੇ ਮੈਨੂੰ ਆਪਣੇ ਆਪ 'ਤੇ ਪੂਰਾ ਕੋਨਫਾਡੈਂਸ ਹੈ ਕਿ ਮੈਂ ਕੱਚੀ ਨਹੀਂ ਹੈ ਕਿਉਂਕਿ ਮੈਨੂੰ ਆਪਣੇ ਆਪ 'ਚ ਪੂਰਾ ਕੌਨਫੀਡੈਂਸ ਹੈ ਕਿ ਮੈਂ ਆਪਣਾ ਕੰਮ ਯਾਨੀ ਕਿ ਮੈਂ ਖੁਦ ਕਰ ਸਕਦੀ ਹਾਂ ਕਿ ਮੈਨੂੰ ਅੱਛੇ ਤੋਂ ਅੱਛਾ ਯਾਨੀ ਕਿ ਕੰਮ ਕਰਨਾ ਪਸੰਦ ਹੈ ਕਿ ਨਵੇਂ ਤੋਂ ਨਵੇਂ ਤਰੀਕੇ ਸਿੱਖਣੇ ਚੰਗੀ ਲੱਗਦੇ ਹੈ ਮੇਰੀ ਯਾਨੀ ਕਿ ਜਿਹੜੀ ਸਾਸੂ ਮਾਂ ਉਹ ਪੂਰੀ ਫੁੱਲ ਡਿਪਲੋਮਾ ਸਟਿਚਿੰਗ 'ਚ ਉਹਨਾਂ ਨੇ ਮੈਨੂੰ ਮੈਨੂੰ ਇਸ ਕੰਮ ਦੇ ਵਿੱਚ ਫੁੱਲ ਐਕਸਪਰਟ ਬਣਾਇਆ ਇਸ ਕਰਕੇ ਕਿ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਕਿ ਜਿਹਨਾਂ ਨੇ ਮੈਨੂੰ ਇਸ ਜਗ੍ਹਾ 'ਤੇ ਖੜਾਤਾ ਮੇਰੇ ਪੈਰ ਜੰਮ ਗਏ ਮਤਲਬ ਜਿਹੜੀ ਕੰਮ ਕਰ ਰਹੀ ਹਾਂ ਅੱਜ ਦੇ ਟਾਈਮ 'ਚ ਮੈਂ ਆਪਣੀਆਂ ਬੇਟੀਆਂ ਨੂੰ ਵੀ ਇਹੀ ਕੰਮ ਦੇ ਵਿੱਚ ਅੱਗੇ ਲਿਜਾਣਾ ਚਾਹੁੰਦੀ ਹਾਂ ਕਿਉਂਕਿ ਹੁਣ ਅੱਜ ਦੇ ਟਾਈਮ ਦੇ ਵਿੱਚ ਇਹ ਹੈ ਕਿ ਜਿਹੜੇ ਬੱਚੇ ਆ ਇਹ ਉਹ ਵੀ ਆਪਣੇ ਹੱਥ ਨਾਲ ਇਹ ਕੰਮ ਕਰਨ ਲੱਗ ਜਾਣ ਅਤੇ ਉਹਨਾਂ ਨੂੰ ਅੱਗੇ ਵੀ ਬਹੁਤ ਜ਼ਿਆਦਾ ਆਪਣਾ ਘਰ ਦੇ ਘਰ ਕਿਸੇ ਦੀ ਬਾਹਰ ਜਾ ਕੇ ਮਿੰਨਤ ਨਹੀਂ ਕਰਨੀ ਪੈਂਦੀ ਮਤਲਬ ਸਿੱਖਣ ਸਿੱਖੇ ਹੋਣ ਬੱਚੀਆਂ ਦਾ ਖਾਸ ਕਰਕੇ ਜੇ ਆਪਣਾ ਕੰਮ ਖੁਦ ਕੱਪੜੇ ਸੀਨੇ ਸਿੱਖੇ ਹੋਣ ਉਹਨਾਂ ਨੂੰ ਸਿਲਾਈ ਮਾਰਨੀ ਕੋਈ ਔਖੀ ਨਹੀਂ ਲੱਗੇਗੀ ਇਸ ਕਰਕੇ ਯਾਨੀ ਕਿ ਜਿਹੜਾ ਕੁੜੀਆਂ ਨੂੰ ਆਪਣੇ ਪੈਰਾਂ 'ਤੇ ਯਾਨੀ ਕਿ ਖੜ੍ਹੇ ਹੋਣਾ ਚਾਹੀਦਾ ਮੈਂ ਇਹੀ ਕਹੂੰਗੀ ਕਿ ਬਸ ਬਾਹਰੋਂ ਨਾ ਬਾਹਰੋਂ ਦੇਣੀ ਸਵਾਈ ਔਖੀ ਲੱਗਦੀ ਆਪਣਾ ਘਰ ਕਰੋ ਜਿੰਨਾ ਹੋ ਸਕੇ ਸਤਿ ਸ਼੍ਰੀ ਅਕਾਲ ਜੀ